ਕਈ ਵਿਅਕਤੀਆਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਹੁੰਦਾ ਕਿ ਉਹ ਬਰੱਸ਼ ਕਿਵੇਂ ਫੜਨ ਕਈ ਵਿਅਕਤੀ ਬਰੱਸ਼ ਕਿਸੇ ਕਿਸੇ ਤਰ੍ਹਾਂ ਕਿਵੇਂ ਫੜ ਲੈਂਦੇ ਆ ਕੋਈ ਕਿਵੇਂ ਫੜ ਲੈਂਦਾ ਇਸ ਹਿਸਾਬ ਨਾਲ ਸਾਡੀ ਡਰਾਇੰਗ ਵਧੀਆ ਨਹੀਂ ਹੁੰਦੀ ਅਤੇ ਸਾਨੂੰ ਇਸ ਇਸ ਵਿੱਚ ਉਹਨਾਂ ਨੂੰ ਕਲਰ ਮਿਲਾਉਣ ਦਾ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਲਰ ਮਿਲਾ ਕੇ ਕਿਹੜਾ ਕਲਰ ਬਣਨਾ ਹੈ ਅਤੇ ਇਸ ਗੱਲ 'ਤੇ ਵੀ ਪ੍ਰੋਬਲਮ ਆਉਂਦੀ ਹੈ ਅਤੇ ਸਾਨੂੰ ਵਧੀਆ ਟਰੇਨਰ ਤੋਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਅਤੇ ਸਾਨੂੰ ਕਲਰ ਮਿਲਾਉਣੇ ਵੀ ਸਿੱਖਣੇ ਵਧੀਆ ਆਉਣੇ ਚਾਹੀਦੇ ਹਨ ਅਤੇ ਇਸ ਵਿੱਚ ਸਾਨੂੰ ਅਲੱਗ ਅਲੱਗ ਕਲਰ ਬਣਾਉਣ ਲਈ ਅਲੱਗ ਅਲੱਗ ਰੰਗਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਜਿਸ ਜਿਸ ਨਾਲ ਅਸੀਂ ਬਹੁਤ ਵਧੀਆ ਕਲਰ ਬਣਾ ਸਕਦੇ ਅੱਡ ਅੱਡ ਰੰਗ ਦੇ ਬਹੁਤ ਸੋਹਣੇ ਕਲਰ ਬਣਾ ਸਕਦੇ ਹਾਂ ਅਤੇ ਇਸ ਵਾਸਤੇ ਸਾਨੂੰ ਬਹੁਤ ਟ੍ਰੇਨਰ ਦੀ ਲੋੜ ਪੈਂਦੀ ਹੈ ਅਤੇ ਅਸੀਂ ਕਿਸੇ ਵੀ ਟਰੇ ਵਧੀਆ ਟ੍ਰੇਨਰ ਤੋਂ ਟ੍ਰੇਨਿੰਗ ਲੈ ਸਕਦੇ ਹਾਂ ਜੇ ਜਿਸ ਜਿਸ ਨਾਲ ਸਾਨੂੰ ਵਧੀਆ ਡਰਾਇੰਗ ਆ ਸਕੇ ਅਤੇ ਅਸੀਂ ਵਧੀਆ ਚਿੱਤਰ ਬਣਾ ਸਕੀਏ ਉਸ 'ਚ ਬਰੱਸ਼ ਫੜਨ ਦਾ ਵੀ ਸਾਨੂੰ ਪਤਾ ਲੱਗ ਜਾਏ ਕਿਵੇਂ ਫੜਨਾ ਹੈ ਅਤੇ ਅਸੀਂ ਕਲਰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਅਸੀਂ ਵਧੀਆ ਕਲਾਕਾਰ ਬਣ ਸਕਦੇ ਹਾਂ